ਆਪਣੇ ਇਤਿਹਾਸ ਦੌਰਾਨ ਪੰਜਾਬੀ ਭਾਸ਼ਾ ਨੇ ਹੋਰ ਭਾਸ਼ਾਵਾਂ ਅਤੇ ਸੱਭਿਆਚਾਰ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਵੇਂ ਕਿ ਅੱਜ ਦੀ ਨੌਜਵਾਨ ਪੀੜੀ ਪੜ੍ਹੇ ਲਿਖੇ ਪੀੜੀ ਪੜ੍ਹ ਲਿਖ ਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ ਅਤੇ ਉਸ ਤਰਤਾ ਸੱਭਿਆਚਾਰ ਅਪਣਾ ਰਹੀ ਹੈ ਅਤੇ ਆਪਣੀ ਪੰਜਾਬੀ ਬੋਲੀ ਨੂੰ ਵੀ ਛੱਡ ਰਹੀ ਹੈ ਉਹ ਬਾਹਰ ਜਾ ਕੇ ਪੰਜਾਬੀ ਪਹਿਰਾਵਾ ਛੱਡ ਕੇ ਪੰਜਾਬੀ ਬੋਲੀ ਛੱਡ ਕੇ ਪਰ ਤਾਂ ਪੱਛਮੀ ਪਹਿਰਾਵਾ ਅਤੇ ਪੱਛਮੀ ਭਾਸ਼ਾ ਅਪਣਾ ਰਹੇ ਹਨ ਇਸਨੇ ਸਾਡੇ ਪੰਜਾਬ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਮੈਂ ਆਪਣੇ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਦੇਸ਼ ਵਿੱਚ ਹੀ ਵਧੀਆ ਰੋਜ਼ਗਾਰ ਪ੍ਰਾਪਤ ਕਰਨ ਅਤੇ ਆਪਣੀ ਪੰਜਾਬੀ ਭਾਸ਼ਾ ਨੂੰ ਕਾਇਮ ਰੱਖਣ ਆਪਣੇ ਬੱਚਿਆਂ ਨਾਲ ਵੀ ਉਹ ਪੰਜਾਬੀ 'ਚ ਗੱਲ ਕਰਨ ਅਤੇ ਸਕੂਲਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਰੱਖਿਆ ਜਾਵੇ ਅਤੇ ਬੱਚਿਆਂ ਨਾਲ ਪੰਜਾਬੀ ਭਾਸ਼ਾ ਬੋਲੀ ਜਾਵੇ ਤਾਂ ਜੋ ਸਾਡੀ ਪੰਜਾਬੀ ਭਾਸ਼ਾ ਹਮੇਸ਼ਾ ਬੋਲੀ ਜਾਵੇ